ਜੇ ਮੈਂ ਆਪਣੀ ਸਭ ਤੋਂ ਮਾਣ ਵਾਲੀ ਪ੍ਰਾਪਤੀ ਦੀ ਗੱਲ ਦੱਸਾਂ ਤਾਂ ਦੋ ਹਜ਼ਾਰ ਗਿਆਰਾਂ ਦੋ ਹਜ਼ਾਰ ਬਾਰਾਂ ਦੇ ਦਿੱਲੀ ਯੂਨੀਵਰਸਿਟੀ ਦੇ ਭੰਗੜਾ ਕੋਮਪੀਟੀਸ਼ਨ 'ਚ ਸਾਡੀ ਟੀਮ ਉਸ ਸਾਲ ਜੇਤੂ ਰਹੀ ਸੀ